ਭੰਗੜਾ ਪੰਜਾਬ ਦਾ ਇੱਕ ਪ੍ਰਸਿੱਧ ਨਾਚ ਹੈ ਇਹ ਹਰ ਖੁਸ਼ੀ ਦੇ ਮੌਕੇ ਵਿੱਚ ਪਾਇਆ ਜਾਂਦਾ ਹੈ ਜਿਵੇਂ ਕਿ ਲੋਹੜੀ ਦੇ ਤਿਉਹਾਰ 'ਤੇ ਲੋਹੜੀ ਦੇ ਤਿਉਹਾਰ 'ਤੇ ਭੰਗੜਾ ਪਾ ਕੇ ਨੱਚ ਕੇ ਭੰਗੜਾ ਪਾ ਕੇ ਲੋਹੜੀ ਮਨਾਈ ਜਾਂਦੀ ਹੈ ਅਤੇ ਵਿਆਹ ਖੁਸ਼ੀ ਦੇ ਆਪਣੀ ਖੁਸ਼ੀ ਵਿਆਹ ਖੁਸ਼ੀ ਦੇ ਟੈਮ ਵੀ ਭੰਗੜਾ ਪਾਇਆ ਜਾਂਦਾ ਮੁੰਡੇ ਦੇ ਜਨਮਦਿਨ ਕੁੜੀ ਦੇ ਜਨਮਦਿਨ 'ਤੇ ਵਿਆਹ ਸ਼ਾਦੀ ਆਦਿ 'ਤੇ ਭੰਗੜਾ ਪਾਇਆ ਜਾਂਦਾ ਹੈ ਪੰਜਾ ਭੰਗੜਾ ਪੰਜਾਬ 'ਚ ਵੀ ਵਿਸਾਖੀ ਦੇ ਦਿਨਾਂ ਵਿੱਚ ਵੀ ਪਾਇਆ ਜਾਂਦਾ ਹੈ ਭੰਗੜਾ ਪੰਜਾਬ ਦਾ ਪ੍ਰਸਿਧ ਤਿਉਹਾਰ ਹੈ ਇੱਥੇ ਹਰ ਖੁਸ਼ੀ ਦੇ ਮੌਕੇ 'ਤੇ ਭੰਗੜਾ ਪਾਇਆ ਜਾਂਦਾ ਹੈ ਅਤੇ ਇਹ ਭੰਗੜਾ ਕੁੜੀਆਂ ਮੁੰਡੇ ਸਾਰੇ ਇਕੱਠੇ ਮਿਲ ਕੇ ਪਾਉਂਦੇ ਹੈ ਅਤੇ ਕੁੜੀਆਂ ਮੁੰਡੇ ਅਲੱਗ ਅਲੱਗ ਹੋ ਕੇ ਵੀ ਪਾਉਂਦੇ ਨੇ ਭੰਗੜਾ ਬਹੁਤ ਹੀ ਵਧੀਆ ਅਤੇ ਚੰਗਾ ਨਾਚ ਹੈ ਇਹ ਪੰਜਾਬ ਵਿੱਚ ਹੀ ਪਾਇਆ ਜਾਂਦਾ ਹੈ ਭੰਗੜਾ